ਪੰਜਾਬੀ ਵਿਆਹ ਰਸਮਾਂ 'ਚ ਬੰਨੇ ਹੁੰਦੇ ਹਨ ਅਤੇ ਹਰ ਧਰਮ ਦੇ ਅੰਦਰ ਕਿਉਂਕਿ ਪੰਜਾਬ ਅੰਦਰ ਬਹੁਤ ਸਾਰੇ ਧਰਮ ਦੇ ਲੋਕ ਵੱਸ ਕਰਦੇ ਹਨ ਅਤੇ ਸਾਂਝੀ ਜੇ ਵਿਆਹ ਦੇ ਵਿੱਚ ਹਰ ਧਰਮ ਦੇ ਲੋਕ ਆਪਣੇ ਆਪਣੇ ਤਰੀਕੇ ਨਾਲ ਵਿਆਹਾਂ ਨੂੰ ਮਨਾਉਂਦੇ ਹਨ ਅਤੇ ਵਿਆਹ ਕਰਦੇ ਹਨ ਅਕਸਰ ਲਾੜੀਆਂ ਨੂੰ ਜਿੱਦਾਂ ਸਿੱਖ ਵਿਆਹਾਂ ਦੇ ਅੰਦਰ ਕਿਰਪਾਨਾਂ ਸੋਹਣੇ ਤਰੀਕੇ ਨਾਲ ਕੱਢੇ ਹੋਏ ਸ਼ਸਤਰ ਕੜੇ ਬਸਤਰ ਕੱਪੜੇ ਬਾਣੇ ਚੱਕਰ ਦੁਮਾਲੇ ਦੇ ਦੁਮਾਲੇ ਦੇ ਸ਼ਸਤਰ ਆਦਿ ਇਹ ਸਭ ਚੀਜ਼ਾਂ ਅਕਸਰ ਜ਼ਿਆਦਾ ਦਿੰਦੇ ਹਨ ਅਤੇ ਹੋਰ ਆਮ ਵਿਆਹਾਂ 'ਤੇ ਆਮ ਆਮ ਪਿੰਡਾਂ 'ਚ ਲੋਕ ਜ਼ਿਆਦਾਤਰ ਹੱਥ ਨਾਲ ਕੱਢੀਆਂ ਹੋਈਆਂ ਬੁਣੀਆਂ ਹੋਈਆਂ ਜਾਂ ਤਾਂ ਸੂਟ ਲੋਈਆਂ ਫੁਲਕਾਰੀਆਂ ਅਤੇ ਵਿਛਾਉਣੇ ਪੁਰਾਣੇ ਸਮਿਆਂ ਦੇ ਵਿੱਚ ਵਿਛੋਣੇ ਅਤੇ ਰਜਾਈਆਂ ਦੇ ਛਾੜ ਜ਼ਿਆਦਾ ਦਿੱਤੇ ਜਾਂਦੇ ਸਨ ਜਾਂ ਚਾਦਰਾਂ ਹੱਥ ਨਾਲ ਕੱਢ ਕੇ ਬੁਣੀਆਂ ਹੋਈਆਂ ਜਾਂ ਕੰਧਾਂ 'ਤੇ ਟੰਗਣ ਵਾਲੇ ਪੇਂਟਿੰਗਾਂ ਦੇ ਸਟਾਈਲ ਦੇ ਅੰਦਰ ਕੱਪੜੇ ਦੇ ਉੱਤੇ ਬੁਣ ਕੇ ਚਿੱਤਰ ਵਾਹੇ ਜਾਂਦੇ ਹਨ ਜਿਹਨਾਂ ਨੂੰ ਅਕਸਰ ਦਿੱਤਾ ਜਾਂਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਅਤੇ ਹੋਰ ਹੱਥੀਂ ਲਿਖ ਕੇ ਚਿੱਠੀਆਂ ਵੀ ਦੇ ਦਿੱਤੀਆਂ ਜਾਂਦੀਆਂ ਸਨ ਪਿਆਰ ਨਾਲ ਦੋਸਤਾਂ ਵੱਲੋਂ ਕਿਤਾਬਾਂ ਵੀ ਦੇਖਦੀਆਂ ਰਹਿੰਦੀਆਂ ਨੇ ਜ਼ਿਆਦਾਤਰ ਅੱਜ ਕੱਲ੍ਹ ਕਿਤਾਬਾਂ ਦਾ ਜ਼ਿਆਦਾ ਚੱਲ ਰਿਹਾ ਏ ਹੋਰ ਦਾਜ ਦੀ ਰਹੀ ਗੱਲ ਦਾਜ ਪਹਿਲਾਂ ਜ਼ਿਆਦਾ ਹੁੰਦੇ ਸੀ ਅੱਜ ਕੱਲ੍ਹ ਦਾਜ ਦੀ ਜਿਹੜੀ ਰਸਮ ਹੈ ਪ੍ਰਥਾ ਏ ਇਹ ਘੱਟ ਗਈ ਏ ਅੱਜ ਕੱਲ੍ਹ ਲੋਕ ਦਾਜ ਲੈਣਾ ਜਾਂ ਦੇਣਾ ਚੰਗਾ ਨਹੀਂ ਸਮਝਦੇ ਪਰ ਫਿਰ ਵੀ ਜਦੋਂ ਦਾਜ ਦਿੱਤਾ ਜਾਂਦਾ ਹੈ ਤਾਂ ਪੁਰਾਣੇ ਸਮਿਆਂ ਦੇ ਵਿੱਚ ਤਾਂ ਮੰਜੇ ਪੇਟੀਆਂ ਰਜਾਈਆਂ ਜੋ ਵੀ ਚੀਜ਼ ਕੰਮ ਆ ਸਕਦੀ ਸੀ ਉਹ ਦਿੱਤੀ ਜਾਂਦੀ ਸੀਗੀ ਪਰਿਵਾਰ ਦੇ ਅੱਜ ਕੱਲ੍ਹ ਸਮੇਂ ਦੇ ਬਦਲਣ ਨਾਲ ਕਾਰਾਂ ਵਗੈਰਾ ਦੇ ਦਿੰਦੇ ਨੇ ਲੋਕ ਹਾਂਜੀ ਬਸ